ਹਾਂਜੀ ਸਾਡੇ ਏਰੀਏ ਦੇ ਵਿੱਚ ਘੁੰਮਣ ਲਈ ਜਗ੍ਹਾ ਸਾਡੇ ਕੋਲ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਹੈ ਜੀ ਜੋ ਕਿ ਬੜੀ ਹੀ ਜਬਰਦਸਤ ਜਗ੍ਹਾ ਦੂਰੋਂ ਦੂਰੋਂ ਦੁਨੀਆ ਘੁੰਮਣ ਆਉਂਦੀ ਹੈ ਅਤੇ ਅਟਾਰੀ ਬਾਰਡਰ ਹੈ ਜਿੱਥੇ ਅਸੀਂ ਬੱਸ 'ਤੇ ਵੀ ਜਾ ਸਕਦੇ ਹਾਂ ਟਰੇਨ 'ਤੇ ਵੀ ਜਾ ਸਕਦੇ ਆਪਣੇ ਸਾਧਨ 'ਤੇ ਵੀ ਜਾ ਸਕਦੇ ਹਾਂ ਸਾਡੇ ਲਾਗੇ ਜਲੰਧਰ ਨਕੋਦਰ ਜਗ੍ਹਾ ਹੈ ਜੀ ਇੱਕ ਇਤਿਹਾਸਿਕ ਘੁੰਮਣ ਦੇ ਵਾਸਤੇ ਉਹ ਪਠਾਨਕੋਟ ਸਾਡੇ ਜਲਿਆਂਵਾਲਾ ਬਾਗ ਹੈ ਜਿੱਥੇ ਕਾਫੀ ਪਹਿਲਾਂ ਇੱਕ ਗੋਲੀਕਾਂਡ ਹੋਇਆ ਸੀ ਸਾਡੇ ਇਤਿਹਾਸਕ ਜਗ੍ਹਾ ਗੁਰਦੁਆਰਾ ਬਾਠ ਸਾਹਿਬ ਹੈ ਸ੍ਰੀ ਚੰਦ ਜੀ ਅਤੇ ਕਾਫੀ ਮਾਤਾ ਦੇ ਮੰਦਿਰ ਹਨ ਅਤੇ ਕਾਠਗੜ੍ਹ ਜੋ ਕਿ ਸ਼ਿਵ ਜੀ ਦਾ ਮੰਦਿਰ ਹੈ ਵੇਖਣ ਦੇ ਯੋਗ ਜੁਗਿਆਲ ਡੈਮ ਜਿਹਦੀ ਕਿ ਚੀਲ ਛੱਤੀ ਸੈਂਤੀ ਕਿਲੋਮੀਟਰ ਹੈ ਉਹ ਬਹੁਤ ਹੀ ਅਦਭੁਤ ਦ੍ਰਿਸ਼ ਹੈ ਘੁੰਮਣ ਲਈ ਅਤੇ ਉਹਦੇ ਵਿੱਚ ਇੱਕ ਮਿੰਨੀ ਗੋਆ ਅਤੇ ਜਿੱਥੇ ਕਿ ਪਾਂਡਵਾਂ ਨੇ ਆਪਣਾ ਅਗਿਆਤਵਾਸ ਕੱਟਿਆ ਸੀ ਮੁਖੇਸਰਾਂ ਧਾਮ ਉਹ ਵੀ ਉਸ ਦੇ ਨਾਲ ਹੀ ਸਥਿਤ ਹੈ ਅਤੇ ਸਾਡੇ ਹੋਰ ਕੋਲ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦੁਆਰਾ ਚੋਲਾ ਸਾਹਿਬ ਇੱਥੇ ਬਾਬੇ ਨਾਨਕ ਨੇ ਚੋਲਾ ਤਿਆਗਿਆ ਸੀ ਉਹ ਬੜੀ ਮਸ਼ਹੂਰ ਜਗ੍ਹਾ ਅਤੇ ਸਾਡੇ ਕਥਰੋਰ ਏਰੀਏ ਦੇ ਵਿੱਚ ਕਈ ਸੌ ਕਿੱਲੇ ਦੇ ਵਿੱਚ ਫੈਲਿਆ ਜੰਗਲਾਤ ਹੈ ਜਿੱਥੇ ਅਲੱਗ ਅਲੱਗ ਤਰ੍ਹਾਂ ਦੇ ਪਸ਼ੂ ਪਕਸ਼ੀ ਹਨ ਅਤੇ ਉਹਨੂੰ ਪਿਕਨਿਕ ਤੌਰ 'ਤੇ ਘੁੰਮਣ ਲਈ ਵੀ ਕੁਝ ਏਰੀਆ ਦਿੱਤਾ ਹੋਇਆ ਉਹ ਬੜੀ ਦਿਲਚਸਪ ਜਗ੍ਹਾ ਹੈ ਔਰ ਉੱਥੇ ਅੰਦਰ ਝੀਲ ਹੈ ਲੇਕ ਹੈ ਬੋਰਡਿੰਗ ਹੈ ਅਤੇ ਸੈਕਲਿੰਗ ਕਰਨ ਦਾ ਵੀ ਉੱਥੇ ਮੌਕਾ ਮਿਲਦਾ ਹੈ ਜੋ ਕਿ ਰੈਂਟ 'ਤੇ ਸਾਈਕਲ ਰੈਂਟ 'ਤੇ ਬੋਡਿੰਗ ਕਰਨ ਦਾ ਮੌਕਾ ਮਿਲਦਾ ਹੈ ਔਰ ਬੜੀ ਹੀ ਕੁਦਰਤੀ ਨੈਚਰਲੀ ਜਗ੍ਹਾ ਹੈ ਅਤੇ ਹੋਰ ਸਾਡੇ ਪੰਜਾਬ 'ਚ ਕਾਫੀ ਏਰੀਆ ਘੁੰਮਣ ਨੂੰ ਹੈ ਪਠਾਨਕੋਟ ਪਹਾੜੀ ਏਰੀਆ ਅਤੇ ਇੱਧਰ ਸਾਡੇ ਹੇਠਾਂ ਪਲੇਨ ਏਰੀਆ ਦੋਨੇ ਚੀਜ਼ਾਂ ਦਾ ਕਾਫੀ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ